ਸਤਿ ਸ਼੍ਰੀ ਅਕਾਲ ਸਰ ਮੈਂ ਇੱਕ ਵਿਦਿਆਰਥੀ ਹਾਂ ਜੋ ਪਿੰਡ ਤੋਂ ਸ਼ਹਿਰ ਆਈ ਹਾਂ ਮੇਰਾ ਆਧਾਰ ਕਾਰਡ ਵੀ ਮੈਨੂੰ ਯਾਦ ਨਹੀਂ ਸੀ ਕਿ ਮੇਰਾ ਆਧਾਰ ਕਾਰਡ ਵੀ ਅਪਡੇਟ ਹੋਣ ਦੀ ਜ਼ਰੂਰਤ ਹੈ ਮੈਨੂੰ ਮੈਂ ਆਪਣੇ ਮਿੱਤਰਾਂ ਦੋਸਤਾਂ ਮਿੱਤਰਾਂ ਸਹੇਲੀਆਂ ਕੋਲੋਂ ਪੁੱਛਿਆ ਕਿ ਆਧਾਰ ਕਾਰਡ ਅਪਡੇਟ ਕਰਨ ਲਈ ਕੀ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਸੇ ਨੇ ਕਿਹਾ ਕਿ ਤੁਹਾਨੂੰ ਆਨਲਾਈਨ ਕਰਨਾ ਚਾਹੀਦਾ ਹੈ ਅਪਡੇਟ ਅਤੇ ਕਿਸੇ ਨੇ ਕਿਹਾ ਕਿ ਤੁਸੀਂ ਆਫਲਾਈਨ ਜਾਂ ਨਜ਼ਦੀਕੀ ਕਿਸੇ ਆਧਾਰ ਕੇਂਦਰ ਵਿੱਚ ਜਾ ਕੇ ਆਪਣਾ ਆਧਾਰ ਕਾਰਡ ਅਪਡੇਟ ਕਰਵਾ ਲਓ ਪਰ ਮੈਨੂੰ ਆਪਣੇ ਆਧਾਰ ਕਾ ਅਪਡੇਟ ਕਰਵਾਉਣ ਲਈ ਆਧਾਰ ਕੇਂਦਰ ਦਾ ਪਤਾ ਨਹੀਂ ਹੈ ਇਸ ਕਰਕੇ ਮੈਨੂੰ ਆਪਣਾ ਆਧਾਰ ਕਾਰਡ ਆਧਾਰ ਕਾਰਡ ਨੂੰ ਅਪਡੇਟ ਕਰਨ ਦੀ ਸਲਾਹ ਦਿੱਤੀ ਜਾਵੇ ਕਿ ਮੈਂ ਆਪਣਾ ਆਧਾਰ ਕਾਰਡ ਬਹੁਤ ਹੀ ਜਲਦੀ ਅਪਡੇਟ ਕਰਵਾ ਸਕਾਂ ਇਸ ਲਈ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ